ਸਿੱਖਿਆ ਰੁਜ਼ਗਾਰ ਅਤੇ ਸਮਾਜਿਕ ਸਥਿਤੀਆਂ ਦੇ ਰੂਪ ਵਿੱਚ ਸ਼ਹੀਦ ਭਗਤ ਸਿੰਘ ਨਗਰ ਵਿੱਚ ਔਰਤਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਸਮੱਸਿਆ ਆਉਂਦੀ ਹੈਗੀ ਹੈ ਉਹ ਹੁੰਦੀ ਹੈ ਲਿੰਗ ਸਮਾਨਤਾ ਜਿੱਦਾਂ ਹੁਣ ਆਪਾਂ ਦੇਖਿਆ ਜਾਵੇ ਕੋਈ ਵੀ ਜਿਹੜਾ ਬੰਦਾ ਹੁੰਦਾ ਹੈਗਾ ਹੈ ਉਹਦੇ ਵਿੱਚ ਉਹਦੇ ਜੀਵਨ ਵਿੱਚ ਉਹਦਾ ਜੈਂਡਰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਥਾਨ ਨਿਭਾਉਂਦਾ ਹੈਗਾ ਏ ਕਿਉਂਕਿ ਆਪਾਂ ਦੇਖਿਆ ਜਾਵੇ ਕੋਈ ਵੀ ਜਿੱਦਾਂ ਹੁਣ ਸਾਡਾ ਜਿਹੜਾ ਸਮਾਜ ਹੈਗਾ ਏ ਉਹ ਮਰਦ ਪ੍ਰਧਾਨ ਸਮਾਜ ਹੈ ਉਹਦੇ ਵਿੱਚ ਜਿਹੜੀਆ ਔਰਤਾਂ ਨੂੰ ਹੈਗਾ ਏ ਉਹ ਥੋੜ੍ਹਾ ਥੱਲਾ ਸਮਝਿਆ ਜਾਂਦਾ ਹੈਗਾ ਏ ਇਹਦੇ ਵਿੱਚ ਜਿੱਦਾਂ ਹੁਣ ਦੇਖਿਆ ਜਾਵੇ ਜਿਹੜੇ ਮਰਦ ਹੁੰਦੇ ਹੈਗੇ ਹੈ ਭਾਵ ਕਿ ਲੜਕੇ ਲੜਕਿਆਂ ਨੂੰ ਪੜ੍ਹਨ ਲਈ ਪ੍ਰੇਰਿਆ ਜਾਂਦਾ ਹੈਗਾ ਜਿਹੜੀਆਂ ਕੁੜੀਆਂ ਹੁੰਦੀਆਂ ਹੈਗੀਆਂ ਏਂ ਕੁੜੀਆਂ ਨੂੰ ਕਹਿੰਦੇ ਵੀ ਇਹਨੇ ਚੌਂਕਾ ਚੁੱਲ੍ਹਾ ਹੀ ਕਰਨਾ ਏ ਐਦੀਂ ਹੀ ਸਰਜੂਂਗਾ ਇਹਨਾਂ ਦਾ ਉਹ ਤੋਂ ਇਲਾਵਾ ਜਿਹੜਾ ਰੁਜ਼ਗਾਰ ਹੈ ਜਿੱਦਾਂ ਹੁਣ ਆਪਾਂ ਦੇਖਿਆ ਜਾਵੇ ਇਹਨਾਂ ਨੂੰ ਜ ਗ ਚੰਗੀ ਤਰ੍ਹਾਂ ਇਹਨਾਂ ਦੀ ਪੜਚੋਲ ਕੀਤੀ ਜਾਵੇ ਤਾਂ ਜਿਹੜਾ ਜਿਹੜਾ ਔਰਤਾਂ ਹੁੰਦੀਆਂ ਹੈਗੀਆਂ ਏ ਔਰਤਾਂ ਨੂੰ ਜੇ ਆਪਾਂ ਥੱਲੇ ਤਾਂ ਸਾਨੂੰ ਔਰਤਾਂ ਜਿੱਦਾਂ ਮਿਲਦੀਆਂ ਹੈਗੀਆਂ ਜਿਹੜੇ ਥੱਲੇ ਦਾ ਤਾਂ ਕਲਰਕ ਵਗੈਰਾ ਹੋ ਗਿਆ ਥੱਲੜੇ ਅਹੁਦਿਆ 'ਤੇ ਜੇ ਆਪਾਂ ਜਿਹੜੀ ਔਰਤਾਂ ਦੀ ਜਿਹੜੀ ਹੈ ਉੱਚ ਆਹੁਦੇ ਹੁੰਦੇ ਉਹਨਾਂ ਦੀ ਪੜਚੋਲ ਕੀਤੀ ਜਾਵੇ ਤਾਂ ਉੱਥੇ ਜਿਹੜੀ ਔਰਤਾਂ ਦੀ ਹਿੱਸੇਦਾਰੀ ਹੈ ਦੋ ਤੋਂ ਚਾਰ ਪ੍ਰਸੈਂਟ ਤੋਂ ਜ਼ਿਆਦਾ ਨਹੀਂ ਦੇਖਣ ਨੂੰ ਮਿਲਦੀ ਹੈਗੀ ਹੈ ਇਹ ਸਾਰਾ ਕੁਝ ਕਿੱਦਾਂ ਹੁੰਦਾ ਹੈਗਾ ਏ ਕਿਉਂਕਿ ਉਹਨਾਂ ਨੂੰ ਪੜ੍ਹਾਇਆ ਨਹੀਂ ਜਾਂਦਾ ਹੈਗਾ ਏ ਅਤੇ ਉਹਨਾਂ ਦੀ ਜਾਂ ਉਹਨਾਂ ਨੂੰ ਪੜ੍ਹਾਇਆ ਨਹੀਂ ਜਾਂਦਾ ਇਸ ਕਰਕੇ ਉਹਨਾਂ ਦੀ ਜਿਹੜੀ ਸਮਾਜ ਦੇ ਵਿੱਚ ਜਿਹੜੀ ਸਥਿਤੀ ਵੀ ਉਹ ਵੀ ਕੋਈ ਜ਼ਿਆਦਾ ਠੀਕ ਨਹੀਂ ਹੁੰਦੀ ਹੈਗੀ ਹੈ